ਸਾਡੇ ਘਰ ਦੇ ਆਲੇ ਦੁਆਲੇ ਬੜਾ ਹੀ ਗੰਦ ਪਿਆ ਹੋਇਆ ਹੈ ਜਿਸ ਨੂੰ ਸਾਫ ਕਰਨ ਲਈ ਸਾਨੂੰ ਖੁਦ ਹੀ ਮੁਹਿਮ ਸ਼ੁਰੂ ਕਰਨੀ ਪੈ ਰਹੀ ਹੈ ਇਹ ਮੁਹਿੰਮ ਵਿੱਚ ਲੱਖਾਂ ਕਰੋੜਾਂ ਲੋਕਾਂ ਨੂੰ ਆਪਾਂ ਸ਼ਾਮਿਲ ਕਰ ਰਹੇ ਹਾਂ ਜਿਸ ਕਰਕੇ ਸਾਡੇ ਆਲੇ ਦੁਆਲੇ ਦੀ ਕ੍ਰਿਆਵਾਂ ਨੂੰ ਸੁਧਾਰੀ ਜਾ ਸਕਣ ਸਾਡੇ ਪ੍ਰਧਾਨ ਮੰਤਰੀ ਨੇ ਵੀ ਸਵੱਚ ਭਾਰਤ ਅਭਿਆਨ ਸ਼ੁਰੂ ਕੀਤਾ ਹੈ ਜਿਸ ਕਰਕੇ ਸਾਨੂੰ ਇਹ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਣਾ ਚਾਦਾ ਹੈ ਜਿਸ ਕਰਕੇ ਸਾਡੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖ ਸਕਣ ਤੇ ਜਾਦਾ ਤੋਂ ਜਾਦਾ ਪੇੜ ਉਗਾ ਸਕਣ ਜਿਸ ਕਰਕੇ ਸਾਡੀ ਸਿਹਤ ਵੀ ਚੰਗੀ ਰਵੇ ਸਾਡਾ ਵਾਤਾਵਰਨ ਵੀ ਪਵਿੱਤਰ ਰਵੇ ਜਿਸ ਕਰਕੇ ਸਾਡੀ ਬਿਮਾਰੀਆਂ ਦੇ ਹੋਣ ਦਾ ਡਰ ਜਿਹੜਾ ਹੈ ਘੱਟ ਜਾਵੇ ਜੇ ਆਪ ਆਪਣਾ ਆਲਾ ਦੁਆਲਾ ਸਾਫ ਰਵੇਗਾ ਤੇ ਸਾਨੂੰ ਬਿਮਾਰੀਆਂ ਵੀ ਘੱਟ ਕਰਨਗੀਆਂ ਇਹ ਬਿਮਾਰੀਆਂ ਸਾਡੀ ਸਿਹਤ ਨੂੰ ਬਹੁਤ ਜ਼ਾਦਾ ਨੁਕਸਾਨ ਪਹੁੰਚਾ ਰਹੀਆਂ ਹਨ ਜਿਸ ਕਰਕੇ ਸਾਡੇ ਆਲੇ ਦੁਆਲੇ ਨੂੰ ਸਾਫ ਰੱਖਣ ਲਈ ਸਾਨੂੰ ਆਪਣਾ ਮੁਹਿੰਮ ਸ਼ੁਰੂ ਕਰਨਾ ਪੈ ਰਿਹਾ ਹੈ ਕੋਈ ਇੱਕ ਜਣਾ ਵੀ ਅੱਗੇ ਆਵੇਗਾ ਤੇ ਸਾਡੀ ਇਲਾਕਿਆਂ ਨੂੰ ਸਧਾਰਿਆ ਜਾ ਸਕਦਾ ਹੈ ਕਿਸੀ ਕੱਲੇ ਦੇ ਨਾਲ ਇਹ ਮੁਮਕਿਨ ਨਹੀਂ ਹੋ ਸਕਦਾ ਹੈ ਤੇ ਸਾਨੂੰ ਮੁਹਿਮ ਵਿੱਚ ਵੀਹ ਜਾਂ ਪੱਚੀ ਲੋਕਾਂ ਨੂੰ ਅੱਗੇ ਲੈ ਕੇ ਆਣਾ ਪੈਣਾ ਹੈ ਜਿਸ ਕਰਕੇ ਰੋਜ਼ ਮਹੱਲੇ ਮਹੱਲੇ ਜਾ ਕੇ ਸਫਾਈ ਕਰਨੀ ਪੈਣੀ ਹੈ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣਾ ਪੈਣਾ ਹੈ ਜਿਸ ਕਰਕੇ ਸਾਡੇ ਪਰਿਵਾਰ ਨੂੰ ਤਾਂ ਸਿਹਤ ਮੰਦ ਰਵੇ ਤੇ ਆਪਣਾ ਪਰਿਵਾਰ ਸੁਖ ਸੁੱਖ ਸੁਖੀ ਰਵੇ ਜਿਸ ਕਰਕੇ ਸਾਨੂੰ ਸਾਫ ਸੁਥਰਾ ਖਾਣ ਪਾਣ ਰੱਖਣਾ ਚਾਹੀਦਾ ਹੈ ਤੇ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਲਈ ਸਾਨੂੰ ਬੜੀ ਸਾਰੀ ਵੀ ਯੋਜਨਾਵਾਂ ਬਣਾਣੀਆ ਚਾਹੀਦੀਆਂ ਹਨ ਤੇ ਹਰ ਵਾਰੀ ਇਹ ਯੋਜਨਾ ਨੂੰ ਅਧੂਰਾ ਨਹੀਂ ਛੱਡਣਾ ਚਾਹੀਦਾ ਹੈ ਜਿਸ ਕਰਕੇ ਸਾਡਾ ਜਿਹੜਾ ਆਲਾ ਦੁਆਰਾ ਹੈ ਉਹ ਸੁਰਸ਼ਿਤ ਰਵੇ ਤੇ ਜਿਸ ਕਰਕੇ ਸਾਡਾ ਜਿਹੜਾ ਇਲਾਕਾ ਜਿਹੜਾ ਹੈ ਉਹ ਹੋਰ ਅੱਗੇ ਵਧਣ ਜਿਸ ਕਰਕੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਵੀ ਇਹ ਯੋਜਨਾ ਨੂੰ ਅੱਗੇ ਵਧਾਇਆ ਹੈ ਜਿਸ ਦਾ ਸਵੱਚ ਭਾਰਤ ਅਭਿਆਨ ਨਾਲ ਜੁੜਿਆ ਗਿਆ ਹੈ ਤੇ ਉਹ ਸਵੱਚ ਭਾਰਤ ਅਭਿਆਨ ਸਾਡੇ ਇਲਾਕਿਆਂ ਤੋਂ ਵੀ ਸ਼ੁਰੂ ਹੋ ਸਾਡੇ ਇਲਾਕੇ ਹੀ ਸਾਫ ਸੁਥਰੇ ਰਵਣਗੇ ਤਾਂ ਹੀ ਉਹ ਮੋੜ ਲਵੇਗਾ ਧੰਨਵਾਦ